ਬਦਲਦੇ ਮੌਸਮ ਦਾ ਸਾਡੇ ਖੇਤਰ ਦੀ ਖੇਤੀ 'ਤੇ ਬਹੁਤ ਅਸਰ ਪੈ ਰਿਹਾ ਹੈ ਹੜ੍ਹ ਦੇ ਹੋਣ ਦੇ ਕਾਰਨ ਸਾਡੇ ਸਾਰੀ ਫਸਲਾਂ ਖ਼ਰਾਬ ਹੋ ਜਾਂਦੀਆਂ ਨੇ ਜਿਸ ਕਰਕੇ ਉਨ੍ਹਾਂ ਨੂੰ ਫਸਲ ਨੂੰ ਤਿਆਰ ਹੋਣ 'ਚ ਬਹੁਤ ਜ਼ਿਆਦਾ ਸਮੇਂ ਲੱਗਦਾ ਹੈ ਅਤੇ ਜ਼ਿਆਦਾ ਸੁੱਕਾ ਹੋਣ ਕਰਕੇ ਫਸਲ ਵੀ ਤਦ ਵੀ ਖ਼ਰਾਬ ਹੋ ਜਾਂਦੀਆਂ ਨੇ ਤਾਂ ਕਿ ਉਹਨਾਂ ਨੂੰ ਪਾਣੀ ਪੋ ਸਹੀ ਤਰੀਕੇ ਦੇ ਪਾਣੀ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਵੱਢਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮ ਫਸਲ ਨੂੰ ਬਹੁਤ ਮੁਸ਼ਕਿਲ ਹੁੰਦਾ ਹੈ ਵੱਢਣ ਲਈ ਸਰਦੀਆਂ ਵਿੱਚ ਫਸਲਾਂ ਨੂੰ ਸਹੀ ਤਰ੍ਹਾਂ ਦੀ ਧੁੱਪ ਨਹੀਂ ਮਿਲਦਾ ਜਿਸ ਕਰਕੇ ਉਹ ਚੰਗੀ ਤਰ੍ਹਾਂ ਵੱਢ ਨਹੀਂ ਸਕਦੇ ਅਤੇ ਨਾ ਹੀ ਉਹਨਾਂ ਨੂੰ ਉਨ੍ਹਾਂ ਵਿੱਚ ਚੰਗੀ ਤਰ੍ਹਾਂ ਧੁੱਪ ਲੱਗਦੀ ਹੈ ਜਿਸ ਕਰਕੇ ਉਹ ਉਨ੍ਹਾਂ ਉਨ੍ਹੇ ਵਿੱਚ ਡੈਮਿਜ ਉਹ ਫਸਲਾਂ ਥੋੜ੍ਹੇ ਦਿਨਾਂ ਵਿੱਚ ਹੀ ਡੈਮਜ ਹੋਣ ਲੱਗਦੇ ਨੇ ਚੱਕਰਵਾਤ ਤੂਫ਼ਾਨ ਗੜ੍ਹੇ ਕਾਰਨ ਫਸਲਾਂ ਬਹੁਤ ਜ਼ਿਆਦਾ ਹੀ ਖ਼ਰਾਬ ਹੋ ਜਾਂਦੀਆਂ ਨੇ ਜਿਸ ਕਰਕੇ ਕਿਸਾਨ ਸਭ ਲੋਕਾਂ ਨੂੰ ਕਿਸਾਨਾਂ ਨੂੰ ਸਭ ਕਿਸਾਨਾਂ ਨੂੰ ਉਹਨਾਂ ਦੀ ਬਹੁਤ ਹੀ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਹੈ ਫਸਲਾਂ ਦੀ ਖ਼ਰਾਬ ਹੋਣ ਦੇ ਕਾਰਨ ਫਸਲਾਂ ਨੂੰ ਬਚਾਉਣ ਲਈ ਪੈ ਫਸਲਾਂ ਦੇ ਖੇਤਾਂ ਦੇ ਸਾਰੇ ਸਾਈਡ ਸਾਈਡ ਸਾਨੂੰ ਗ੍ਰੀਨ ਨੈਟ ਲਗਾਓ ਦੇਣਾ ਚਾਹੀਦਾ ਹੈ ਜਿਸ ਕਰਕੇ ਉਹ ਅਸਾਨੀ ਨਾਲ ਹੜ੍ਹ ਚੱਕਰਵਾਤ ਸਰਦੀਆਂ ਸੋਕੇ ਸਭ ਤੋਂ ਬਚ ਸਕੇ ਅਤੇ ਉਹਨਾਂ ਨੂੰ ਉਸ ਵਿੱਚ ਸਾਰੇ ਖਾਦ ਦਵਾਈ ਕੀਟਨਾਸ਼ਕ ਸਭ ਕੁਛ ਅੱਛੀ ਤਰ੍ਹਾਂ ਦੇਣ ਨਾਲ ਉਹ ਉਨ੍ਹਾਂ ਨੂੰ ਸਾਰੇ ਬਿਮਾਰੇ ਪੌਦਿਆਂ ਨੂੰ ਸਾਰੀ ਬਿਮਾਰੀਆਂ ਤੋਂ ਦੂਰ ਰੱਖਦਾ ਹੈ ਫਸਲਾਂ ਨੂੰ ਅਤੇ ਉਹ ਅੱਛੀ ਫਸਲ ਹੁੰਦੀ ਹੈ ਅਤੇ ਉਹਨਾਂ ਵਿੱਚ ਸਾਰੇ ਪੌਸ਼ਟਿਕ ਅਹਾਰ ਹੁੰਦਾ ਹੈ ਜੋ ਇਨਸਾਨ ਖਾ ਕੇ ਉਹਨਾਂ ਨੂੰ ਤੰਦਰੁਸਤ ਮਹਿਸੂਲ ਕਰ ਮਹਿਸੂਸ ਕਰਦਾ ਹੈ